ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਤ ਭਾਸ਼ਾ ਹੈ ਇਹ ਭਾਸ਼ਾ ਸਾਨੂੰ ਸਾਡੇ ਗੁਰੂਆਂ ਦੀ ਦੇਣ ਹੈ ਪੰਜਾਬੀ ਬੋਲੀ ਬਿਲਕੁਲ ਸਰਲ ਅਤੇ ਸਿੱਧੀ ਭਾਸ਼ਾ ਹੈ ਇਹ ਬੋਲੀ ਸਿੱਖਣ ਦੀ ਲੋੜ ਨਹੀਂ ਪੈਂਦੀ ਇਸਨੂੰ ਸੁਣ ਕੇ ਹੀ ਇਹ ਆਪਣੇ ਆਪ ਬੋਲਣੀ ਆ ਜਾਂਦੀ ਹੈ ਦੂਜੇ ਪ੍ਰਾਂਤਾਂ ਦੇ ਲੋਕ ਇੱਥੇ ਆ ਕੇ ਪੰਜਾਬੀ ਭਾਸ਼ਾ ਸਿੱਖ ਜਾਂਦੇ ਹਨ ਅਤੇ ਆਪਣੀ ਭਾਸ਼ਾ ਨੂੰ ਬੋਲਣਾ ਘੱਟ ਕਰ ਦਿੰਦੇ ਹਨ ਇਸ ਭਾਸ਼ਾ ਨੇ ਪੰਜਾਬ ਤੋਂ ਇਲਾਵਾ ਹੋਰ ਪ੍ਰਾਂਤਾਂ ਵਿੱਚ ਵੀ ਬੋਲੀ ਜਾਂਦੀ ਹੈ ਇਸ ਭਾਸ਼ਾ ਨੂੰ ਪਾਕਿਸਤਾਨ ਵਿੱਚ ਵੀ ਬੋਲਿਆ